ਮੇਰੀਆਂ ਮਨਪਸੰਦ ਸ਼ੈਲੀਆਂ ਵਿੱਚ ਕਾਵਕ ਸ਼ੈਲੀ ਸਰਵੋਤਮ ਹੈ ਮੈਂ ਕਾਵ ਅਧੀਨ ਕਾਵ ਪ੍ਰਸੰਗ ਕਾਵ ਸਿਧਾਂਤ ਸਾਰੀਆਂ ਚੀਜ਼ਾਂ ਨਾਲ ਵਿਚਰਦਾ ਸਾਰੀਆਂ ਚੀਜ਼ਾਂ ਨੂੰ ਪੜ੍ਹਦਾ ਹਾਂ ਇਹਨਾਂ ਦੇ ਨਾਲ ਤੁਰਨ ਦੀ ਕੋਸ਼ਿਸ਼ ਕਰਦਾ ਹਾਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਇਹਨਾਂ ਦੇ ਸਿਧਾਂਤਾਂ ਰਾਹੀਂ ਕਵਿਤਾ ਨੂੰ ਪੜ੍ਹਨ ਲਈ ਉਹਦੇ ਵਿਸ਼ੇ ਨੂੰ ਦੇਖਣ ਲਈ ਉਹਦੀਆਂ ਬਣਤਰਾਂ ਨੂੰ ਲੱਭਣ ਲਈ ਮੈਂ ਕੋਸ਼ਿਸ਼ ਕਰਦਾ ਰਹਿੰਦਾ ਹਾਂ ਕਵਿਤਾ ਇਕ ਅਜਿਹਾ ਸਾਧਨ ਹੈ ਜਿਸ ਦੇ ਨਾਲ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਨੂੰ ਦੱਸਦੇ ਹਾਂ ਅਤੇ ਮੈਨੂੰ ਇੰਝ ਲੱਗਦਾ ਕਿ ਜਦੋਂ ਮੈਂ ਕਵਿਤਾ ਪੜ੍ਹਦਾ ਹਾਂ ਤਾਂ ਮੈਂ ਕਿਸੇ ਨੂੰ ਸਮਝ ਰਿਹਾ ਹਾਂ ਕਿਸਦੇ ਮਨ ਦੇ ਭਾਵ ਮੇਰੇ ਅੰਦਰ ਉਤਰ ਰਹੇ ਹਨ ਮੈਂ ਉਹਨਾਂ ਲਾਈਨਾਂ ਨਾਲ ਉਹਨਾਂ ਸੰਵਾਦਾਂ ਨਾਲ ਆਪਣੇ ਆਪ ਨੂੰ ਇੱਕ ਮਿੱਕ ਕਰਨ ਦੀ ਕੋਸ਼ਿਸ਼ ਕਰਦਾ ਹਾਂ ਮੈਂ ਬਿਲਕੁਲ ਬਹੁਤ ਛੇਤ ਇਸ ਥੋੜ੍ਹਾ ਸਮਾਂ ਪਹਿਲਾਂ ਲੂਣਾ ਸ਼ਿਵ ਕੁਮਾਰ ਦੀ ਪੜ੍ਹੀ ਸੀ ਮੈਨੂੰ ਉਹਦੇ ਵਿੱਚੋਂ ਇੱਕ ਕਵਿਤਾ ਬਹੁਤ ਚੰਗੀ ਲੱਗੀ ਉਹਦੇ ਵਿੱਚ ਇੱਕ ਨਟੀ ਅਤੇ ਨਟ ਦਾ ਸੰਵਾਦ ਹੈ ਕਿ ਸੁਣੋ ਸੁਆਮੀ ਕੇਹਾ ਸੁਹਾਵਾ ਪੰਛੀ ਬੋਲ ਰਿਹਾ ਜਿਉਂ ਕਿਸੇ ਪ੍ਰੇਮੀ ਆਪਣੇ ਪ੍ਰੇਮੀ ਦਾ ਨਾਮ ਲਿਆ ਕਿਉਂ ਬਾਂਸ ਦੀ ਪਾਟੀ ਭੋਰ 'ਚੌਂ ਇੱਕ ਰੁਮਕਾ ਲਾਂਘ ਗਿਆ ਜਿਉਂ ਸੇਜ ਸੱਜਣ ਦੀ ਮਾਣਦੀ ਦਾ ਹਾਸਾ ਨਿਕਲ ਗਿਆ ਪ੍ਰਥਮ ਪ੍ਰੇਮ ਦੇ ਪ੍ਰਥਮ ਮੇਲ ਦੇ ਪ੍ਰਥਮ ਹੀ ਸ਼ਬਦ ਜਿਹਾ ਦਰਦ ਪਰੂਚੇ ਕਿਸੇ ਗੀਤ ਦੇ ਅੰਤਿਮ ਬੋਲ ਜਿਹਾ ਇਸ ਕਾਵਕ ਲਹਿਜ਼ੇ ਤੋਂ ਬਾਅਦ ਤੁਸੀਂ ਕੁਝ ਵੀ ਸੋਚ ਨਹੀਂ ਸਕਦੇ ਉਸ ਸ਼ੈਲੀ ਦੇ ਨਾਲ ਤੁਸੀਂ ਤੁਰਦੇ ਜਾਂਦੇ ਹੋ ਇਸੇ ਤਰ੍ਹਾਂ ਹੀ ਉਹ ਜਦੋਂ ਈਰਾ ਨੂੰ ਆਪਣਾ ਦੁੱਖ ਦੱਸਦੀ ਹੈ ਆਪਣੀ ਲੂਣਾ ਈਰਾ ਨੂੰ ਆਪਣਾ ਦੁੱਖ ਦੱਸਦੀ ਹੈ ਤਾਂ ਈਰਾ ਨੂੰ ਉਹ ਕੀ ਕਹਿੰਦੀ ਹੈ ਕਿ ਈਰਾ ਤੂੰ ਵੀ ਸੱਚ ਸੁਣਾਇਆ ਤੂੰ ਵੀ ਲੂਣਾ ਦੇ ਜ਼ਖ਼ਮਾਂ 'ਤੇ ਮੱਤਾਂ ਦਾ ਬਸ ਮੱਲਮ ਹੈ ਲਾਇਆ ਤੈਨੂੰ ਵੀ ਕੁੱਝ ਸਮਝ ਨਾ ਆਇਆ ਜੇ ਪਿਓ ਧੀ ਦਾ ਰੂਪ ਹੰਢਾਵੇ ਤਾਂ ਲੋਕਾਂ ਨੂੰ ਲਾਜ ਨਾ ਆਵੇ ਜੇ ਲੂਣਾ ਪੂਰਨ ਨੂੰ ਚਾਹਵੇ ਚ੍ਰਿਤਰਹੀਣ ਕਿਉਂ ਕਹੇ ਜੀਭ ਜਹਾਨ ਦੀ ਇਸ ਤਰ੍ਹਾਂ ਸਮਾਜ ਵਿੱਚ ਰਹਿੰਦੇ ਹੋਏ ਕਵਿਤਾ ਕਵਿਤਾ ਦੇ ਭਾਵ ਸਮਾਜ ਦੀ ਵਿਆਖਿਆ ਕਰਦੇ ਹਨ ਸਮਾਜ ਵਿੱਚ ਮਨੁੱਖ ਦੇ ਚਰਿੱਤਰ ਨੂੰ ਉਘਾੜਦੇ ਹਨ ਉਹ ਚਰਿੱਤਰ ਕਿਸ ਤਰ੍ਹਾਂ ਦਾ ਸਮਾਜ ਦਾ ਹੈ ਕਵਿਤਾ ਵਿੱਚ ਸੰਪੂਰਨ ਰੂਪ ਵਿੱਚ ਸਾਨੂੰ ਨਜ਼ਰ ਆ ਜਾਂਦਾ ਹੈ ਸੋ ਇਸ ਤਰ੍ਹਾਂ ਇਹ ਜਿਹੜੀਆਂ ਸ਼ੈਲੀਆਂ ਨੇ ਇਹ ਜਿਹੜੇ ਸਟਾਇਲ ਨੇ ਅੱਜ ਵੀ ਜਦੋਂ ਅਸੀਂ ਕਿਸੇ ਨੂੰ ਇਸ ਤਰ੍ਹਾਂ ਦੀ ਕਵਿਤਾ ਲਿਖਿਆ ਦੇਖਦੇ ਹਾਂ ਭਾਵੇਂ ਸ਼ਿਵ ਸਾਡੇ 'ਚ ਮੌਜੂਦ ਨਹੀਂ ਹੈ ਅਸੀਂ ਕਹਿੰਦੇ ਹਾਂ ਕਿ ਤੂੰ ਸ਼ਿਵ ਵਾਂਗ ਲਿਖ ਰਿਹਾ ਹੈ ਸੋ ਜਿਹੜੀ ਸ਼ੈਲੀ ਹੈ ਇਹ ਮਨੁੱਖ ਦੇ ਉੱਤੇ ਉਹਦਾ ਲੇਬਲ ਹੈ ਇਸ ਸ਼ੈਲੀ ਦੇ ਅਨੁਸਾਰ ਮਨੁੱਖ ਆਪਣੇ ਆਪ ਨੂੰ ਦੁਨੀਆਂ ਤੋਂ ਵੱਖਰਾ ਕਰ ਸਕਦਾ